ਬਠਿੰਡੇ ਦੀ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਫੋਟੋ ਕੈਪਚਰ ਕਰਨ ਲਈ ਇੱਕ ਬਹੁਤ ਹੀ ਸ਼ਾਨਦਾਰ ਸਥਾਨ ਹੈ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੀ ਸਾਰੀ ਇਮਾਰਤ ਭਾਰਤੀ ਰਾਜੇ ਮਹਾਰਾਜਿਆਂ ਦੇ ਸਮੇਂ ਦੀ ਮਹਿਲ ਉਸਾਰੀ ਨਾਲ ਮੇਲ ਖਾਂਦੀ ਹੈ ਉੱਥੇ ਬਹੁਤ ਹੀ ਸੁੰਦਰ ਫੋਟੋਆਂ ਕੈਪਚਰ ਕੀਤੀਆਂ ਜਾ ਸਕਦੀਆਂ ਹਨ ਜੇ ਕਿਸੇ ਨੇ ਫੋਟੋਗ੍ਰਾਫੀ ਲਈ ਕੋਈ ਸ਼ਾਹੀ ਠਾਠ ਬਾਠ ਵਾਲਾ ਥੀਮ ਰੱਖਿਆ ਹੋਵੇ ਤਾਂ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਇੱਕ ਬਹੁਤ ਹੀ ਵਧੀਆ ਸਥਾਨ ਹੈ ਪਰ ਉੱਥੇ ਫੋਟੋਆਂ ਕੈਪਚਰ ਕਰਨ ਲਈ ਪਹਿਲਾਂ ਆਗਿਆ ਲੈਣੀ ਪੈਂਦੀ ਹੈ ਅਤੇ ਜਿਸ ਦਿਨ ਯੂਨੀਵਰਸਿਟੀ ਵਿੱਚ ਛੁੱਟੀ ਹੋਵੇ ਉਸ ਦਿਨ ਹੀ ਯੂਨੀਵਰਸਿਟੀ ਕਰਮਚਾਰੀ ਆਗਿਆ ਦਿੰਦੇ ਹਨ ਬਠਿੰਡੇ ਕਿਲ੍ਹਾ ਮੁਬਾਰਕ ਵਿੱਚ ਵੀ ਫੋਟੋਗ੍ਰਾਫੀ ਕੀਤੀ ਜਾ ਸਕਦੀ ਹੈ ਉੱਥੇ ਫੋਟੋਆਂ ਕਰਨ ਲਈ ਕੋਈ ਆਗਿਆ ਨਹੀਂ ਲੈਣੀ ਪੈਂਦੀ ਪਰ ਉਸ ਕਿਲ੍ਹੇ ਦੀ ਕੁਝ ਥਾਵਾਂ ਤੋਂ ਹਾਲਤ ਖ਼ਰਾਬ ਹੋਣ ਕਰਕੇ ਰੋਕ ਲਗਾਈ ਗਈ ਹੈ ਕਿਉਂਕਿ ਉਸ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੁੰਦਾ ਹੈ ਪਰ ਫਿਰ ਵੀ ਸੁਰੱਖਿਆ ਥਾਵਾਂ 'ਤੇ ਤੁਸੀਂ ਫੋਟੋਆਂ ਕੈਪਚਰ ਕਰ ਸਕਦੇ ਹੋ ਇਸ ਤੋਂ ਇਲਾਵਾ ਘੁੱਦਾ ਦੇ ਜੀਵਨ ਨਗਰ ਵਿੱਚ ਵੀ ਵਧੀਆ ਫੋਟੋਆਂ ਕੈਪਚਰ ਹੋ ਸਕਦੀਆਂ ਹਨ ਉੱਥੇ ਇੱਕ ਪਾਰਕ ਬਣੀ ਹੋਈ ਹੈ ਉੱਥੇ ਹਰ ਤਰ੍ਹਾਂ ਦੀ ਗੁਲਾਬ ਅਤੇ ਹੋਰ ਫੁੱਲਾਂ ਦੇ ਬੂਟੇ ਲੱਗੇ ਹੋਏ ਹਨ ਭਾਵ ਕੁਦਰਤ ਦੇ ਬਹੁਤ ਸਾਰੇ ਨਜ਼ਾਰੇ ਉਸ ਪਾਰਕ ਵਿੱਚ ਹਨ